ਜੇਕਰ ਅਸੀਂ ਗੱਲ ਕਰੀਏ ਕਿੱਤਾ ਮੁਖੀ ਸਿੱਖਿਆ ਬਾਰੇ ਤਾਂ ਇਸ ਨੂੰ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਤਰਖਾਣ ਸਿਲਾਈ ਪੋਈਟਰੀ ਫਾਰਮ ਪਸ਼ੂ ਪਾਲਣ ਅਤੇ ਹੋਰ ਚੀਜ਼ਾਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਤਾਂ ਕਿ ਲੋਕ ਇਹਨਾਂ ਚੀਜ਼ਾਂ ਬਾਰੇ ਸਿੱਖ ਕੇ ਇਹਨਾਂ ਕੰਮਾਂ ਨੂੰ ਅੱਗੇ ਵਧਾ ਸਕਣ ਅਤੇ ਆਪਣੇ ਪੰਜਾਬ ਪੰਜਾਬ ਨੂੰ ਇੱਕ ਵਧੀਆ ਵਧੀਆ ਤਰੀਕੇ ਨਾਲ਼ ਪੂਰੀ ਦੁਨੀਆ ਅੱਗੇ ਪੇਸ਼ ਕਰ ਸਕਣ ਇਹਨਾਂ ਚੀਜ਼ਾਂ ਇਹਨਾਂ ਚੀਜ਼ਾਂ ਕਾਰਨ ਹੀ ਅਸੀਂ ਬਹੁਤ ਵਧੀਆ ਕਮਾ ਸਕਦੇ ਹਾਂ ਅਤੇ ਆਪਣੀ ਬਹੁਤ ਵਧੀਆ ਹੀ ਬਹੁਤ ਵਧੀਆ ਪੇਸ਼ ਕਰ ਸਕਦੇ ਹਾਂ ਲੋਕਾਂ ਅੱਗੇ ਸਾਨੂੰ ਹਮ ਸਾਨੂੰ ਕਿੱਤਾ ਮੁਖੀ ਸਿੱਖਿਆ ਦੇ ਨਾਲ਼ ਹੀ ਬਹੁਤ ਵਧੀਆ ਸਮਾਜ ਬਣਾ ਸਕਦੇ ਹਾਂ ਅਤੇ ਲੋਕਾਂ ਸਾਹਮਣੇ ਆਪਣੀ ਵਧੀਆ ਦਿੱਖ ਬਣਾ ਸਕਦੇ ਹਾਂ ਕਿ ਅਸੀਂ ਵੀ ਅਸੀਂ ਕੁਝ ਨਾ ਕੁਝ ਸਿੱਖ ਕੇ ਆਪਣੀ ਕਮਾਈ ਦਾ ਸਾਧਨ ਸ਼ੁਰੂ ਕਰ ਸਕਦੇ ਹਾਂ ਸਾਨੂੰ ਕਿਸੇ ਦੇ ਮੁਹਤਾਜ ਬਣਨ ਦੀ ਲੋੜ ਨਹੀਂ ਹੈ ਨਾ ਹੀ ਕਿਸੇ ਦੇ ਹੇਠਾਂ ਲੱਗ ਕੇ ਕੰਮ ਕਰਨ ਦੀ ਜ਼ਰੂਰਤ ਹੈ